ਹੈਲੋ ਸਰ ਹਾਂਜੀ ਮੈਨੂੰ ਤੁਹਾਡੀ ਸਾਈਟ ਫਲਿਪਕਾਰਡ ਤੋਂ ਇੱਕ ਕੰਪਲੇਂਟ ਸੀਗੀ ਕਿ ਮੈਂ ਤੁਹਾਡੀ ਸਾਈਟ ਤੋਂ ਇੱਕ ਪ੍ਰੋਡਕਟ ਆਰਡਰ ਕੀਤਾ ਸੀ ਜੋ ਕਿ ਬਹੁਤ ਕੋਸਟਲੀ ਸੀਗਾ ਔਰ ਜਿਸ ਦੀ ਪੇਮੈਂਟ ਮੈਂ ਔਨਲਾਈਨ ਕਰ ਦਿੱਤੀ ਗਈ ਸੀ ਔਰ ਡਿਲੀਵਰੀ ਬੁਆਏ ਆ ਕੇ ਮੈਨੂੰ ਕਹਿ ਰਿਹਾ ਕਿ ਤੁਹਾਡੀ ਪੇਮੈਂਟ ਅਜੇ ਰਿਸੀਵ ਨਹੀਂ ਹੋਈ ਨਾ ਹੀ ਸ਼ੋਅ ਹੋ ਰਹੀ ਆ ਸਾਈਟ 'ਤੇ ਤੁਸੀਂ ਪਹਿਲਾਂ ਪੇਮੈਂਟ ਕਰੋ ਤਾਂ ਹੀ ਤੁਹਾਨੂੰ ਤੁਹਾਡਾ ਆਰਡਰ ਮਿਲੇਗਾ ਔਰ ਮੈਨੂੰ ਉਹ ਆਰਡਰ ਬਹੁਤ ਜ਼ਰੂਰੀ ਸੀ ਔਰ ਤੁਸੀਂ ਪਲੀਜ਼ ਆਪਣੀ ਸਾਈਟ ਚੈੱਕ ਕਰੋ ਕਿਉਂਕਿ ਮੈਂ ਬੁੱਧਵਾਰ ਅਠਾਈ ਤਰੀਕ ਨੂੰ ਤਿੰਨ ਵਜੇ ਇਹ ਪੇਮੈਂਟ ਕੀਤੀ ਸੀ ਆਨਲਾਈਨ ਤੁਹਾਡੀ ਸਾਈਟ 'ਤੇ ਹੀ ਔਰ ਡਿਲੀਵਰੀ ਬੁਆਏ ਕਹਿ ਰਿਹਾ ਵਾ ਕਿ ਅਜੇ ਤੱਕ ਸ਼ੋਅ ਨਹੀਂ ਹੋਈ ਤੁਹਾਡੀ ਸਾਈਟ ਫਲਿੱਪਕਾਟ 'ਤੇ ਔਰ ਪਲੀਜ਼ ਇਸ ਗੱਲ ਦਾ ਮੇਰਾ ਹੱਲ ਕਰੋ ਕਿਉਂਕਿ ਮੈਂ ਇੰਨੀ ਕੋਸਟਲੀ ਪੇਮੈਂਟ ਦੇ ਚੁੱਕੀ ਹਾਂ ਆਲਰੇਡੀ ਅਤੇ ਹੁਣ ਦੁਬਾਰਾ ਤਾਂ ਦਊਂਗੀ ਨਹੀਂ ਅਤੇ ਹੁਣ ਤੁਸੀਂ ਹੀ ਆਪਣੀ ਸਾਈਟ ਚੈੱਕ ਕਰੋ ਐਂਡ ਦੇਖੋ ਮੇਰੀ ਪੇਮੈਂਟ ਕਿਉਂ ਨਹੀਂ ਆ ਰਹੀ ਔਰ ਮੇਰਾ ਇਸ ਗੱਲ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਔਰ ਮੈਨੂੰ ਮੇਰਾ ਪ੍ਰੋਡਕਟ ਰਿਸੀਵ ਹੋਵੇ ਜਾਂ ਮੇਰੀ ਪੇਮੈਂਟ ਵਾਪਸ ਕੀਤੀ ਜਾਵੇ